ਜਾਨਵਰਾਂ ਦੀ ਸਾਂਭ ਸੰਭਾਲ ਲਈ ਸ ਸਾਡੇ ਬਜ਼ੁਰਗ ਕਹਿੰਦੇ ਹਨ ਕੱਚੀ ਲੱਸੀ ਖੱਟੀ ਲੱਸੀ ਦਾ ਛਿੱਟਾ ਮਾਰੋ ਉਹਨਾਂ ਨਾਲ਼ ਮੱਖੀ ਨਹੀਂ ਬਹਿੰਦੀ ਹੈ ਅਤੇ ਇੱਕ ਨਿੰਮ ਦਾ ਧੂੰਆਂ ਵੀ ਕਰਨਾ ਚਾਹੀਦਾ ਏ ਜਿਸ ਨਾਲ਼ ਮੱਛਰ ਨਹੀਂ ਆਉਂਦਾ ਅਤੇ ਜਾਂ ਪਸ਼ੂ ਅਰਾਮ ਨਾਲ਼ ਖੜ੍ਹੇ ਰਹਿੰਦੇ ਹਨ ਬੈਠ ਜਾਂਦੇ ਹਨ ਅਤੇ ਉਸ ਤੋਂ ਬਾਅਦ ਜਿਵੇਂ ਪਸ਼ੂਆਂ ਨੂੰ ਬੈ ਬਾਦੀ ਹੋ ਜਾਂਦੀ ਹੈ ਅਤੇ ਉਹਨਾਂ ਦਾ ਹਾਜ਼ਮਾ ਠੀਕ ਰੱਖਣ ਲਈ ਸੂੰਹ ਅਤੇ ਹਾਲ਼ਿਓ ਦੀ ਵਰਤੋਂ ਕੀਤੀ ਜਾਂਦੀ ਆਂ ਉਹਨਾਂ ਨੂੰ ਦਿਨ ਵਿੱਚ ਇੱਕ ਇੱਕ ਤਸਲੀ ਸੂੰਹ ਦੀ ਅਤੇ ਹਾਲ਼ਿਓ ਦੀ ਮਿਕਸ ਕਰਕੇ ਪਾਈ ਜਾਂਦੀ ਹਨ ਪਾਈ ਜਾਂਦੀ ਹੈ ਅਤੇ ਹੋਰ ਵੀ ਕੁਦਰਤ ਦੇ ਬਹੁਤ ਜ਼ਿਆਦਾ ਜੋ ਕਿ ਪਦਾਰਥ ਹਨ ਜੋ ਕਿ ਪਸ਼ੂਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹਨ ਜਿਵੇਂ ਕਿ ਕਾਲਾ ਨੂਣ ਜੋ ਕਿ ਦੇਸੀ ਨਮਕ ਦੇ ਕਹਾਇਆ ਜਾਂਦਾ ਹੈ ਅਤੇ ਉਹ ਜਦੋਂ ਸਵੇਰੇ ਮੱਝਾਂ ਨੂੰ ਚੋਅ ਕੇ ਹੱਟਦੇ ਹਨ ਪਾਣੀ ਪਿਲਾਉਣ ਤੋਂ ਬਾਅਦ ਅਸੀਂ ਮੱਝਾਂ ਦੀ ਖੁਰਲੀ ਵਿੱਚ ਕਾਲਾ ਨੂਣ ਦੇ ਡਲੇ ਸੁੱਟ ਦਿੰਦੇ ਹਨ ਅਤੇ ਉਹ ਉਹਨੂੰ ਚੱਟੀ ਜਾਂਦੀਆਂ ਹਨ ਜਿਸ ਨਾਲ਼ ਉਹਨਾਂ ਦਾ ਅੰਦਰੂਨੀ ਹਾਜ਼ਮਾ ਅਤੇ ਉਹਨਾਂ ਦਾ ਸਿਹਤ ਤੰਦਰੁਸਤ ਰਹਿੰਦੀ ਹੈ ਇਸ ਵਿਚ ਉਸ ਵਿੱਚ ਮਿਲਨਰਜ਼ ਦੀ ਬਹੁਤ ਹੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਕਿ ਪਸ਼ੂਆਂ ਨੂੰ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਅਤੇ ਉਹਨਾਂ ਦੀ ਸਾਫ਼ ਸਫ਼ਾਈ ਲਈ ਉਨ੍ਹਾਂ ਨੂੰ ਦਿਨ ਵਿੱਚ ਦੋ ਵਾਰ ਨਵਾਇਆ ਜਾਂਦਾ ਹੈ ਇੱਕ ਟਾਈਮ ਸਵੇਰੇ ਜਦੋਂ ਪਾਣੀ ਪੀਦੀਆਂ ਹਨ ਉਸੀ ਟਾਈਮ ਇੱਕ ਟਾਈਮ ਸ਼ਾਮ ਵੇਲ਼ੇ ਅਤੇ ਉਹਨਾਂ ਨੂੰ ਤਿੰਨ ਟਾਈਮ ਕੱਖ ਪਾਏ ਜਾਂਦੇ ਹਨ ਜਿਵੇਂ ਕਿ ਇੱਕ ਤੜਕੇ ਅਤੇ ਇੱਕ ਸ਼ਾਮ ਨੂੰ ਅਤੇ ਦੁਪਹਿਰ ਵੇਲੇ ਉਹਨਾਂ ਨੂੰ ਕੱਖ ਨਾਲ਼ ਥੋੜ੍ਹਾ ਜਿਹਾ ਭਾੜਾ ਵੀ ਪਾਇਆ ਜਾਂਦਾ ਹੈ ਜਿਸ ਵਿੱਚ ਕੈਲਸ਼ੀਅਮ ਵਗੈਰਾ ਹੁੰਦਾ ਹੈ ਅਤੇ ਉਸ ਨਾਲ਼ ਪਸ਼ੂਆਂ ਦਾ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਹੋਰ ਆਦਿ ਚੀਜ਼ਾਂ ਹੁੰਦੀਆਂ ਹਨ ਜੋ ਕਿ ਮੇਰੇ ਦਾਦਾ ਜੀ ਸਾਨੂੰ ਦੱਸਦੇ ਹਨ ਪਸ਼ੂਆਂ ਦਾ ਦੁੱਧ ਵਧਾਉਣ ਲਈ ਦਲ਼ੀਆ ਜੋ ਕਿ ਅਸੀਂ ਦਲ਼ੀਆ ਵੀ ਪੀਂਹਦੇ ਹਨ ਅਤੇ ਫ਼ੀਡ ਨਾਲ਼ ਨਾਲ਼ ਅਸੀਂ ਦਲ਼ੀਆ ਵੀ ਪਾਉਂਦੇ ਹਨ ਉਸ ਨਾਲ਼ ਪਸ਼ੂਆਂ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਉਹਨਾਂ ਉਹ ਉਨ੍ਹਾਂ ਨੂੰ ਹੋਰ ਤਰ੍ਹਾਂ ਦੇ ਕੈਮੀਕਲਾਂ ਤੋਂ ਵੀ ਬਚਾਇਆ ਜਾ ਸਕਦਾ ਹੈ ਜੋ ਕਿ ਉਹਨਾਂ ਲਈ ਹਾਨੀਕਾਰਕ ਹੁੰਦੇ ਹਨ